ਸਤਿ ਸ਼੍ਰੀ ਅਕਾਲ ਸਰ ਮੈਂ ਫ਼ਿਲਮਾਂ ਅਤੇ ਵਿਅੰਜ ਦੇਖਣ ਦਾ ਬਹੁਤ ਸ਼ੌਂਕੀਨ ਹਾਂ ਹਫ਼ਤੇ ਦੇ ਅੰਤਿਮ ਦਿਨਾਂ ਵਿੱਚ ਘਰ ਵਿੱਚ ਹੀ ਰਹਿੰਦਾ ਹਾਂ ਅਤੇ ਇਹ ਮੈਨੂੰ ਬਹੁਤ ਬੋਰਿੰਗ ਲੱਗ ਰਿਹਾ ਹੈ ਮੈਂ ਲਗਭਗ ਸਾਰੀਆਂ ਸੀਰੀਜ ਦੇਖ ਚੁੱਕਾ ਹਾਂ ਅਤੇ ਹੁਣ ਮੈਨੂੰ ਕੋਈ ਹੋਰ ਮਨੋਰੰਜਕ ਅਤੇ ਰੋਮਾਂਚਕ ਲੜੀ ਨਹੀਂ ਲੱਭ ਰਹੀ ਅਤੇ ਜੋ ਜੇ ਕੋਈ ਲੱਭ ਵੀ ਰਹੀ ਹੈ ਤਾਂ ਮੈਨੂੰ ਸਮਝ ਨਹੀਂ ਆਉ ਆਉਂਦਾ ਕਿ ਇਹ ਦੇਖੀ ਜਾ ਸਕਦੀ ਹੈ ਕਿ ਨਹੀਂ ਸੋ ਮੈਂ ਬਹੁਤ ਹੀ ਕਨਫਿਊਜ ਹਾਂ ਫੈਸਲਾ ਲੈਣ ਵਿੱਚ ਮੈਨੂੰ ਬਹੁਤ ਮੁਸ਼ਕਲ ਆ ਰਹੀ ਹੈ ਸੋ ਕਿਰਪਾ ਕਰਕੇ ਮੈਨੂੰ ਕੁਝ ਚੰਗੇ ਵਿਕਲਪ ਦਿੱਤੇ ਜਾਣ ਜਿਸ ਨਾਲ ਮੈਂ ਆਪਣੇ ਵੀਕੈਂਡ ਰੋਮਾਂਚਕ ਬਣਾ ਸਕਾਂ ਅਤੇ ਮੈਨੂੰ ਬੋਰਿੰਗ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ